ਹੈਲੋ ਆਫਟਰਨੂਨ ਮੈਮ ਹਾਂਜੀ ਮੈਮ ਐਕਚੁਲੀ ਨਾ ਮੈਂ ਟੀਚਰ ਲਈ ਅਪਲਾਈ ਕਰਨਾ ਸੀ ਤੁਹਾਡੇ ਸਕੂਲ ਅਤੇ ਕੋਈ ਵੈਕੈਂਸੀ ਹੈ ਕੰਪਿਊਟਰ ਟੀਚਰ ਲਈ ਹਾਂਜੀ ਮੈਂ ਨਾ ਐਕਚੁਲੀ ਬੋਲ ਰਹੀ ਹਾਂ ਮੈਂ ਨਾ ਫਿਲੌਰ ਤੋਂ ਪੜ੍ਹੀ ਹਾਂ ਮੈਂ ਨਾ ਪੀ ਏ ਪੀ ਜਲੰਧਰ ਤੋਂ ਨਾ ਕੰਪਿਊਟਰ ਦਾ ਕੋਰਸ ਕੀਤਾ ਆ ਗੌਰਮੈਂਟ

ਤੁਸੀਂ ਦੱਸੋ ਕਿ ਮੈਂ ਹਾਂਜੀ ਮੈਮ ਮੇਰੇ ਨਾ ਸੈਵਨਟੀ ਫਾਈਵ ਪ੍ਰਸੈਂਟ ਮਾਰਕਸ ਆ ਗ੍ਰੈਜੂਏਸ਼ਨ 'ਚੋਂ ਮੇਰੇ ਹੈਗੇ ਏਟੀ ਪ੍ਰਸੈਂਟ ਹਾਂਜੀ ਮੈਂ ਨਾ ਥੀ ਥ੍ਰੀ ਈਅਰਸ ਦਾ ਕੀਤਾ ਹੈ ਮੈਂ ਕੀਤਾ ਹੋਇਆ ਕੰਪਿਊਟਰ ਟੀਚਰ ਟਰੇਨਿੰਗ ਕੋਰਸ ਕੀਤਾ ਹੋਇਆ ਮੈਮ ਹਾਂਜੀ ਮੈਮ ਐਕਚੁਅਲੀ ਮੈਂ ਨਾ ਪੜ੍ਹਾਇਆ ਹੋਇਆ ਆ ਦੋ ਤਿੰਨ ਸਕੂਲ ਵਿੱਚ ਪੜ੍ਹਾਇਆ ਹੋਇਆ ਮੇਰੀ ਹਾਂਜੀ ਮੈਂ ਜੀ ਐਸ ਮਾਡਲ ਸਕੂਲ ਪੜ੍ਹਾਇਆ ਆ ਅਤੇ ਇਹ ਜਲੰਧਰ ਵਿੱਚ ਹੀ ਆ ਹਾਂਜੀ ਅਤੇ ਇਸ ਤੋਂ ਪਹਿਲਾਂ ਹਾਂਜੀ ਅਸੀਂ ਨਹੀਂ ਅਸੀਂ ਰਹਿੰਦੇ ਲੁਧਿਆਣੇ ਤੋਂ ਮੈਂ ਇਸ ਤੋਂ ਪਹਿਲਾਂ ਪੜ੍ਹਾਇਆ ਆ ਮੋਜਰਨ ਸਕੂਲ 'ਚ ਪੜ੍ਹਾਇਆ ਇੰਗਲਿਸ਼ ਮੀਡੀਅਮ ਸਕੂਲ 'ਚ ਪੜ੍ਹਾਇਆ ਆ ਮੇਰਾ ਐਕਸਪੀਰੀਅੰਸ ਵੀਹ ਸਾਲ ਦਾ ਐਕਸਪੀਰੀਅੰਸ ਹੋ ਗਿਆ ਆ ਮੈਡਮ ਮੈਂ ਛੋਟੀ ਸੀ ਮੈਂ ਔਰ ਜੂਨੀਅਰ ਕਲਾਸਿਸ ਲੈ ਲਊਗੀ ਅਤੇ ਏਟਥ ਤੱਕ ਕੰਪਿਊਟਰ ਕਰਵਾ ਸਕਦੀ ਹਾਂ ਮੈਂ ਤੁਸੀਂ ਮੈਨੂੰ ਦੱਸ ਦੇਣਾ ਅਗਰ ਵਕੈਂਸੀ ਹੋਈ ਤਾਂ ਮੈਨੂੰ ਤੁਸੀਂ ਦੱਸ ਦੇਣਾ ਥੈਂਕ ਯੂ ਜੀ ਹਾਂਜੀ ਮੈਮ ਆਫਿਸ ਵਰਕ ਵੀ ਕਰ ਲੈਂਦੇ ਹਾਂ ਹਾਂਜੀ ਓਕੇ ਮੈਮ ਥੈਂਕ ਯੂ ਓਕੇ ਮੈਮ